ਪੰਜਾਬ ਵਿੱਚ ਕਈ ਪ੍ਰਸਿੱਧ ਆਊਟਡੋਰ ਸੰਗੀਤ ਤਿਉਹਾਰ ਮਨਾਏ ਜਾਂਦੇ ਹਨ ਜਿਵੇਂ ਕਿ ਇੱਕ ਪ੍ਰਸਿੱਧ ਪ੍ਰਸਿੱਧ ਗਾਇਕ ਹੋਇਆ ਹੈ ਸੁਰਜੀਤ ਸਿੰਘ ਬਿੰਦਰਖੀਆ ਜੋ ਕੀ ਬਿੰਦਰਖ ਪਿੰਡ ਤੋਂ ਸੰਬੰਧ ਰੱਖਦੇ ਸਨ ਅਤੇ ਉਹਨਾਂ ਦੀ ਬਰਸੀ ਜੋ ਕਿ ਹਰ ਸਾਲ ਬਿੰਦਰਖ ਪਿੰਡ ਵਿੱਚ ਮਨਾਈ ਜਾਂਦੀ ਹੈ ਇਹ ਬਰਸੀ ਸਤਾਰਾਂ ਅਪ੍ਰੈਲ ਹਰ ਸਾਲ ਮਨਾਈ ਜਾਂਦੀ ਹੈ ਅਤੇ ਬਹੁਤ ਹੀ ਮਾਣ ਬਹੁਤ ਹੀ ਅਨੇਕ ਪ੍ਰਕਾਰ ਦੇ ਸ ਸੰਗੀਤਕਾਰ ਉੱਥੇ ਆਉਂਦੇ ਹੈ ਅਤੇ ਉਸ ਮਹਾਨ ਸ਼ਖਸ਼ੀਅਤ ਨੂੰ ਯਾਦ ਕਰਦੇ ਹਨ ਅਤੇ ਉਸ ਦੇ ਗੀਤ ਗਾਏ ਜਾਂਦੇ ਹਨ ਅਤੇ ਬਹੁਤ ਹੀ ਮੁਕਾਬਲੇ ਵੀ ਕਰਵਾਏ ਜਾਂਦੇ ਹਨ